ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਨਾਲ਼ ਜਿਸ ਨੂੰ ਸ਼ੂਗਰ ਹੁੰਦੀ ਹੈ ਉਸਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਉਹ ਉਸ ਪ੍ਰੋਪਰ ਆਪਣੇ ਆਪ 'ਚ ਸਹੀ ਨਹੀਂ ਹੁੰਦਾ ਸ਼ੂਗਰ ਨੂੰ ਸਹੀ ਕਰਨ ਦੇ ਲਈ ਬਹੁਤ ਸਾਰੇ ਘਰੇਲੂ ਉਪਾਅ ਹਨ ਜਿਵੇਂ ਕਿ ਐਲੋ ਵੇਰਾ ਹੋ ਗਈ ਜੇਕਰ ਐਲੋ ਵੇਰਾ ਹੋਊਂਗੀ ਤਾਂ ਉਹ ਐਲੋ ਵੇਰਾ ਨੂੰ ਐਲੋ ਵੇਰਾ ਦੇ ਵਿੱਚੋਂ ਪਾਣੀ ਕੱਢ ਕੇ ਉਹਦੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਜੇਕਰ ਉਹ ਲਗਾਤਾਰ ਇੱਕ ਹਫਤਾ ਲਉਂਗੇ ਤਾਂ ਉਸਦੇ ਨਾਲ਼ ਬਹੁਤ ਜ਼ਿਆਦਾ ਸਿਹਤ ਨਾਲ ਉਹਦੀ ਸਿਹਤ ਨੂੰ ਇਫੈਕਟ ਪਊਗਾ ਇੱਦਾਂ ਹੌਲ਼ੀ ਹੌਲ਼ੀ ਖਾਣ ਦੇ ਨਾਲ਼ ਉਹਦੀ ਸ਼ੂਗਰ 'ਤੇ ਅ ਉਹਨੂੰ ਆਰਾਮ ਮਿਲ ਸਕਦਾ ਹੈ